ਮੈਨੂੰ ਬਚਪਨ ਤੋਂ ਹੀ ਖਬਰਾਂ ਪੜ੍ਹਨਾ ਸੁਣਨਾ ਜਾਂ ਦੇਖਣ ਦਾ ਸ਼ੌਕ ਰਿਹਾ ਹੈ ਅਤੇ ਅੱਜ ਵੀ ਜ਼ਾਰੀ ਹੈ ਸਾਡੇ ਘਰ ਵਿੱਚ ਬਚਪਨ ਤੋਂ ਹੀ ਦੋ ਅਖਬਾਰਾਂ ਆਉਂਦੀਆਂ ਹਨ ਅਤੇ ਮੈਂ ਇਸ ਨੂੰ ਹਰ ਰੋਜ਼ ਪੜ੍ਹਦਾ ਹੁੰਦਾ ਸਾਂ ਇਸ ਤੋਂ ਇਲਾਵਾ ਜਦੋਂ ਵੀ ਸਮਾਂ ਮਿਲਦਾ ਮੈਂ ਟੀ ਵੀ 'ਤੇ ਵੀ ਖਬਰਾਂ ਸੁਣਨਾ ਪਸੰਦ ਕਰਦਾ ਹਾਂ ਅੱਜ ਕੱਲ੍ਹ ਆਨਲਾਈਨ ਨਿਊਜ਼ ਵੈੱਬਸਾਈਟ ਰਾਹੀਂ ਵੀ ਖਬਰਾਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਮੈਨੂੰ ਖਬਰਾਂ ਪੜ੍ਹਨ ਜਾਂ ਦੇਖਣ ਲਈ ਅਖਬਾਰ ਅਤੇ ਸੁਣਨ ਲਈ ਟੀ ਵੀ ਹੀ ਬਥੇਰੇ ਪਸੰਦ ਹਨ ਅਖਬਾਰਾਂ ਵਿੱਚ ਮੈਨੂੰ ਦੇਸ਼ ਵਿਦੇਸ਼ ਦੀ ਰਾਜਨੀਤੀ ਸਮਾਜਿਕ ਵਪਾਰਿਕ ਧਾਰਮਿਕ ਖੇਡ ਸੰਸਾਰ ਸਿਹਤ ਸਿੱਖਿਆ ਆਦਿ ਵਿਸ਼ਿਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਅਖਬਾਰਾਂ ਵਿੱਚ ਬਹੁਤ ਸਾਰੀਆਂ ਕੰਪਨੀਆਂ ਆਪਣੀਆਂ ਆਪਣੀਆਂ ਚੀਜ਼ਾਂ ਦੇ ਇਸ਼ਤਿਹਾਰ ਦਿੰਦੀਆਂ ਹਨ ਉੱਥੋਂ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਮਿਲਦੀ ਹੈ ਸਰਕਾਰ ਆਪਣੇ ਬਹੁਤ ਸਾਰੇ ਇਸ਼ਤਿਹਾਰ ਜਾਂ ਪ੍ਰੋਗਰਾਮ ਅਖਬਾਰ ਵਿੱਚ ਛਾਪਦੀ ਹੈ ਅਤੇ ਸਾਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਅਖਬਾਰਾਂ ਤੋਂ ਜਾਣਕਾਰੀ ਮਿਲਦੀ ਹੈ ਬਹੁਤ ਸਾਰੀਆਂ ਨੌਕਰੀਆਂ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਆਉਂਦੇ ਹਨ ਅਤੇ ਪੜ੍ਹੇ ਲਿਖੇ ਨੌਜਵਾਨ ਇਹਨਾਂ ਦੇ ਵਿੱਚ ਪੜ੍ਹ ਕੇ ਆਪਣੀ ਨੌਕਰੀ ਦੇ ਲਈ ਬਿਨੈ ਪੱਤਰ ਦਿੰਦੇ ਹਨ ਦੇਸ਼ ਪ੍ਰਦੇਸ਼ ਦੀ ਰਾਜਨੀਤੀ ਵਿੱਚ ਕੀ ਕੁਝ ਵਾਪਰ ਰਿਹਾ ਹੈ ਇਸ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ ਬਹੁਤ ਹੀ ਥੋੜ੍ਹੇ ਪੈਸੇ ਖਰਚ ਕਰਕੇ ਅਸੀਂ ਵਡਮੁੱਲੀ ਜਾਣਕਾਰੀ ਅਖਬਾਰਾਂ ਦਾ ਮਾਧਿਅਮ ਰਾਹੀਂ ਪ੍ਰਾਪਤ ਕਰ ਸਕਦੇ ਹਾਂ ਅਖਬਾਰਾਂ ਤੋਂ ਇਲਾਵਾ ਮੈਨੂੰ ਟੀ ਵੀ 'ਤੇ ਵੀ ਖਬਰਾਂ ਦੇਖਣ ਦਾ ਸ਼ੌਕ ਹੈ ਟੀ ਵੀ 'ਤੇ ਜਿੱਥੇ ਅਸੀਂ ਖਬਰ ਸੁਣਦੇ ਹੀ ਨਹੀਂ ਬਲਕਿ ਉਸ ਨਾਲ ਸਬੰਧਿਤ ਘਟਨਾਕ੍ਰਮ ਦੇਖ ਵੀ ਸਕਦੇ ਹਾਂ ਕਿਹੜੀ ਘਟਨਾ ਕਿਹੜੇ ਸ਼ਹਿਰ ਵਿੱਚ ਕਿਸ ਵੇਲੇ ਵਾਪਰੀ ਉਸਦੀ ਤੁਰੰਤ ਜਾਣਕਾਰੀ ਸਾਨੂੰ ਟੀ ਵੀ ਉੱਤੇ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਅਸੀਂ ਉਹ ਖਬਰ ਸੁਣਨ ਦੇ ਨਾਲ ਨਾਲ ਉਸ ਨੂੰ ਦੇਖ ਵੀ ਸਕਦੇ ਹਾਂ ਟੀ ਵੀ ਉੱਤੇ ਬਹੁਤ ਸਾਰੇ ਇਸ਼ਤਿਹਾਰ ਵੀ ਦਿੱਤੇ ਜਾਂਦੇ ਹਨ ਹਰ ਕੰਪਨੀ ਆਪਣੀ ਆਪਣੀ ਚੀਜ਼ ਦੀ ਵੀਡੀਓ ਦਿਖਾਉਂਦੀ ਹੈ ਜਿਸ 'ਤੇ ਬਹੁਤ ਸਾਰੇ ਉਹ ਲਾਭ ਪ੍ਰਾਪਤ ਆਪਣੀ ਚੀਜ਼ ਦਾ ਪ੍ਰਚਾਰ ਕਰਦੀ ਹੈ ਇਸ ਤੋਂ ਇਲਾਵਾ ਖਬਰਾਂ ਦਾ ਇੱਕ ਹੋਰ ਓਨਲਾਈਨ ਮਾਧਿਅਮ ਵੀ ਹੈ ਜਿਸ ਰਾਹੀਂ ਅਸੀਂ ਖਬਰਾਂ ਦੇਖ ਸਕਦੇ ਹਾਂ ਪਰ ਮੈਨੂੰ ਇਹ ਮਾਧਿਅਮ ਘੱਟ ਪਸੰਦ ਹੈ ਕਿਉਂਕਿ ਓਨਲਾਈਨ ਨਿਊਜ਼ ਸੁਣਨ ਦੇ ਲਈ ਤੁਹਾਡੇ ਕੋਲ ਹਰ ਸਮੇਂ ਗੈਜਟ ਹੋਣਾ ਚਾਹੀਦਾ ਹੈ ਅਤੇ ਉਸ ਉੱਪਰ ਇੰਟਰਨੈਟ ਦਾ ਕਨੈਕਸ਼ਨ ਵੀ ਹੋਣਾ ਚਾਹੀਦਾ ਹੈ ਸੋ ਅੱਜ ਵੀ ਅਖਬਾਰ ਅਤੇ ਟੀ ਵੀ ਹੀ ਮੇਰੀ ਸਮਝ ਅਨੁਸਾਰ ਖਬਰਾਂ ਸੁਣਨ ਅਤੇ ਪੜ੍ਹਨ ਦੇ ਬਹੁਤ ਹੀ ਮਹੱਤਵਪੂਰਨ ਸਾਧਨ ਹਨ